ਸਟੇਜ 'ਤੇ ਗਾਉਂਦੇ ਸਮੇਂ ਅਕਸਰ ਹੀ ਮੈਨੂੰ ਇੱਕ ਡਰ ਹੁੰਦਾ ਆ ਮਨ ਦੇ ਵਿੱਚ ਇੱਕ ਘਬਰਾਹਟ ਹੁੰਦੀ ਹੈ ਕਿ ਜੇ ਮੇਰੀ ਪੁਜ਼ੀਸ਼ਨ ਨਾ ਆਈ ਤਾਂ ਮੈਨੂੰ ਸਾਰੇ ਕੀ ਕਹਿਣਗੇ ਕਿ ਤੂੰ ਇੰਨਾ ਇੰਨੀ ਮਿਹਨਤ ਕੀਤੀ ਅਤੇ ਤੇਰੀ ਪੁਜ਼ੀਸ਼ਨ ਨਹੀਂ ਆਈ ਹਰ ਵਕਤ ਮੇਰੇ ਦਿਲ 'ਚ ਇਹ ਅਹਿਸਾਸ ਅਤੇ ਇਹ ਡਰ ਹੁੰਦਾ ਅਤੇ ਇੱਕ ਵਾਰ ਦੀ ਗੱਲ ਹੈ ਮੈਂ ਉਦੋਂ ਸਕੂਲ ਦੇ ਵਿੱਚ ਪੜ੍ਹਦੀ ਸੀ ਅਤੇ ਸਕੂਲ ਵਿੱਚ ਪੜ੍ਹਦੇ ਇੱਕ ਕੋਂਪੀਟੀਸ਼ਨ ਆਇਆ ਉਸ ਦੇ ਵਿੱਚ ਮੈਂ ਹਿੱਸਾ ਲਿਆ ਅਤੇ ਉਹਦੇ ਕੋਂਪੀਟੀਸ਼ਨ ਦੇ ਵਿੱਚ ਮੇਰੇ ਨਾਲ ਸਾਰੇ ਮੇਰੇ ਦੋਸਤ ਮਿੱਤਰ ਮੇਰੇ ਅਧਿਆਪਕ ਸਾਹਿਬਾਨ ਅਤੇ ਮੇਰੇ ਜੱਜਿਸ ਸੀਗੇ ਜੋ ਅਤੇ ਮੇਰੇ ਪੇਰੈਂਟਸ ਸਾਰੇ ਹੀ ਮੇਰੇ ਸਾਹਮਣੇ ਬੈਠੇ ਸੀ ਅਤੇ ਮੇਰੇ ਮਨ ਦੇ ਵਿੱਚ ਇੱਕ ਡਰ ਸੀਗਾ ਕਿ ਜੇ ਮੇਰੀ ਪੁਜ਼ੀਸ਼ਨ ਨਾ ਆਈ ਇੱਥੇ ਤਾਂ ਇਹ ਸਾਰੇ ਹੱਸਣਗੇ ਮੈਨੂੰ ਗੱਲਾਂ ਕਰਨਗੇ ਕਿ ਹਾਂ ਤੂੰ ਨਹੀਂ ਜਿੱਤੀ ਹੈਗੀ ਤੇਰੀ ਪੁਜ਼ੀਸ਼ਨ ਨਹੀਂ ਆਈ ਹੈਗੀ ਤਾਂ ਮੈਨੂੰ ਬਹੁਤ ਹੀ ਬੁਰਾ ਮਹਿਸੂਸ ਹੋਊਗਾ ਤਾਂ ਮੈਂ ਆਪਣੇ ਡਰ ਨੂੰ ਕੰਟਰੋਲ ਕਰਨ ਦੇ ਲਈ ਮੈਂ ਆਪਣੇ ਮਨ ਦੇ ਵਿੱਚ ਪਹਿਲਾਂ ਤਾਂ ਮੈਡੀਟੇਸ਼ਨ ਕੀਤੀ ਪਰਫੋਰਮੈਂਸ ਸਟਾਰਟ ਹੋਣ ਤੋਂ ਪਹਿਲਾਂ ਮੈਡੀਟੇਸ਼ਨ ਕੀਤੀ ਕਿ ਹਾਂ ਨਹੀਂ ਸਭ ਸਹੀ ਹੋਏਗਾ ਸਭ ਰੱਬ ਦੇਖਦਾ ਆ ਰੱਬ ਜੋ ਵੀ ਕਰਦਾ ਚੰਗੇ ਲਈ ਕਰਦਾ ਮੈਂ ਮਨ ਦੇ ਵਿੱਚ ਆਪਣੇ ਇੱਕ ਇਹੀ ਗੱਲ ਰੱਖ ਕੇ ਆਪਣੀ ਪਰਫੋਰਮੈਂਸ ਦਿੰਦਿਆਂ ਉੱਤਰੀ ਜਦੋਂ ਸਟੇਜ ਤੋਂ ਜੱਜਿਸ ਨੇ ਫਿਰ ਬਾਅਦ 'ਚੋਂ ਰਿਜ਼ਲਟ ਅਨਾਊਸ ਕੀਤਾ ਅਤੇ ਮੇਰੀ ਪੁਜ਼ੀਸ਼ਨ ਵੀ ਆ ਗਈ ਇੱਦਾਂ ਮੇਰੇ ਨਾਲ ਇੱਕ ਵਾਰ ਨਹੀਂ ਹੋਇਆ ਹਰ ਵਾਰੀ ਮੇਰੇ ਨਾਲ ਹੁੰਦਾ ਹੈ ਜਦੋਂ ਵੀ ਮੈਂ ਕੋਈ ਵੀ ਪੁਜ਼ੀਸ਼ਨ ਲੈਣੀ ਹੁੰਦੀ ਆ ਜਾਂ ਫਿਰ ਮੈਂ ਜਦੋਂ ਵੀ ਕੋਈ ਕੋਂਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੀ ਹਾਂ ਮੈਂ ਕਦੇ ਕੋਈ ਕੋਂਪੀਟੀਸ਼ਨ ਨਹੀਂ ਛੱਡਿਆ ਕੋਈ ਵੀ ਪ੍ਰਤਿਯੋਗਤਾ ਆਉਂਦੀ ਹੈ ਤਾਂ ਮੈਂ ਪਹਿਲਾਂ ਅੱਗੇ ਵੱਧ ਕੇ ਮੈਂ ਹਿੱਸਾ ਲੈਂਦੀ ਹਾਂ ਅਤੇ ਹਰ ਵਾਰੀ ਮੇਰੇ ਮਨ ਦੇ ਵਿੱਚ ਇਹ ਡਰ ਹੁੰਦਾ ਹੈ ਹਰ ਵਾਰੀ ਡਰ ਨੂੰ ਦੂਰ ਕਰਨ ਦੇ ਲਈ ਮੈਂ ਹਮੇਸ਼ਾ ਮੈਡੀਟੇਸ਼ਨ ਕਰਦੀ ਹਾਂ ਸਾਹ ਨੂੰ ਅੰਦਰ ਖਿੱਚਣਾ ਫਿਰ ਬਾਹਰ ਕੱਢਣਾ ਇਸ ਦੇ ਨਾਲ ਕੀ ਹੁੰਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਹਮੇਸ਼ਾ ਰੱਬ ਜੀ 'ਤੇ ਭਰੋਸਾ ਰੱਖਿਆ ਹੁੰਦਾ ਹੈ ਕਿ ਜੇ ਮੈਂ ਮਿਹਨਤ ਕੀਤੀ ਹੈ ਤਾਂ ਮੈਨੂੰ ਮਿਹਨਤ ਦਾ ਫਲ ਵੀ ਜ਼ਰੂਰ ਮਿਲੇਗਾ ਅਤੇ ਉਹੀ ਹੁੰਦਾ ਆ ਜੇ ਆਪਾਂ ਚੰਗਾ ਸੋਚਾਂਗੇ ਤਾਂ ਚੰਗਾ ਹੀ ਹੋਊਗਾ ਸੋ ਹਰ ਵਾਰੀ ਮੈਂ ਆਪਣੀ ਪਰਫ ਪਰਫੋਰਮੈਂਸ ਦੇਣ ਤੋਂ ਪਹਿਲਾਂ ਚੰਗਾ ਹੀ ਸੋਚ ਕੇ ਰੱਖਦੀ ਹਾਂ ਕਿ ਹਾਂ ਚੰਗਾ ਹੀ ਹੋਊਗਾ ਸੋ ਇਹ ਸੀਗਾ ਕਿ ਮੈਂ ਆਪਣੇ ਡਰ ਨੂੰ ਦੂਰ ਕਰਨ ਦੇ ਲਈ ਅਪ ਹਮੇਸ਼ਾਂ ਮਨ ਨੂੰ ਟਿਕਾ ਕੇ ਰੱਖਦੀ ਹਾਂ ਸ਼ਾਂਤ ਰੱਖਦੀ ਹਾਂ ਅਤੇ ਵਾਹਿਗੁਰੂ ਜੀ 'ਤੇ ਭਰੋਸਾ ਰੱਖਦੀ ਹਾਂ